ਮੈਂ ਵਿਜੇ ਕੁਮਾਰ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਅਜਿਹਾ ਸਮਾਂ ਹੈ ਕਿ ਕਿਸੇ ਨਾਲ ਯਾਰੀ ਦੋਸਤੀ ਵਿੱਚ ਕਈ ਵਾਰ ਉੱਚਾ ਨੀਵਾਂ ਬੋਲਿਆ ਜਾਂਦਾ ਹੈ ਉੱਚਾ ਨੀਵਾਂ ਬੋਲ ਕੇ ਕਈ ਵਾਰ ਤਾਂ ਇੱਥੋਂ ਤੱਕ ਕਿ ਲੜਾਈ ਵੀ ਹੋ ਸਕਦੀ ਹੈ ਪਿੱਛੇ ਜਿਹੀ ਦੋ ਦੋਸਤਾਂ ਦੀ ਆਪਸ ਵਿੱਚ ਗੱਲਾਂ ਗੱਲਾਂ ਵਿੱਚ ਹੀ ਬਹਿਸ ਹੋ ਗਈ ਜਦੋਂ ਕਿ ਉਹ ਬਹਿਸ ਇੱਕ ਭਿਆਨਕ ਲੜਾਈ ਦਾ ਰੂਪ ਲੈ ਗਈ ਅਤੇ ਉਹ ਦੋਵੇਂ ਲੜਦੇ ਲੜਦੇ ਕਿਤੇ ਜ਼ਿਆਦਾ ਹੀ ਦੂਰ ਪਹੁੰਚ ਗਏ ਉਹਨਾਂ ਨੇ ਇੱਕ ਦੂਜੇ ਦੀਆਂ ਬਾਹਵਾਂ ਫੜ ਲਈਆਂ ਜਦੋਂ ਕਿ ਇੱਕ ਨੇ ਇੱਕ ਦੀ ਬਾਂਹ ਨੂੰ ਮਰੋੜ ਕੇ ਉਸ ਦੀ ਬਾਂਹ ਨੂੰ ਤੋੜ ਦਿੱਤਾ ਫਿਰ ਕੀ ਸੀ ਕਿਸੇ ਸਿਆਣੇ ਬੰਦੇ ਨੇ ਵਿੱਚ ਉਹਨਾਂ ਨੂੰ ਪੈ ਕੇ ਉਹਨਾਂ ਨੂੰ ਸਮਝਾਇਆ ਅਤੇ ਉਹਨਾਂ ਦੀ ਲੜਾਈ ਝਗੜੇ ਨੂੰ ਪਰਾ ਕੀਤਾ ਫਿਰ ਉਸ ਦੇ ਇਲਾਜ ਦੀ ਵਾਰੀ ਆਈ ਜਦੋਂ ਉਸ ਸ਼ਾਮ ਨੂੰ ਸਾਰਿਆਂ ਨੇ ਉਸ ਨੂੰ ਹੋਸਪਿਟਲ ਲਿਜਾ ਕੇ ਪਹਿਲਾਂ ਐਕਸਰਾ ਕਰਵਾਉਣ ਦੀ ਗੱਲ ਕੀਤੀ ਫਿਰ ਉਹ ਦੋਸਤ ਵੀ ਉਸ ਦੇ ਨਾਲ ਗਿਆ ਅਤੇ ਉਸਨੇ ਉਸ ਤੋਂ ਮੁਆਫ਼ੀ ਦੀ ਪ੍ਰਕਿਰਿਆ ਆਰੰਭ ਕੀਤੀ ਕਈ ਵਾਰ ਆਪਣੇ ਆਪ ਨੂੰ ਮੁਆਫ਼ੀ ਮੰਗਦਾ ਹੋਇਆ ਉਹ ਵਿਅਕਤੀ ਉਸ ਤੋਂ ਪਰਾ ਹੋ ਗਿਆ ਇਸ ਤਰ੍ਹਾਂ ਉਸ ਦਾ ਐਕਸਰੇ ਹੋਇਆ ਫਿਰ ਡਾਕਟਰ ਨੇ ਪੰਦਰਾਂ ਦਿਨਾਂ ਲਈ ਉਸ 'ਤੇ ਪਲਾਸਟਰ ਜੜ ਦਿੱਤਾ ਇਸ ਤਰ੍ਹਾਂ ਉਸ ਨੂੰ ਇਸ ਗੱਲ ਦੀ ਸਮਝ ਆ ਗਈ ਕਿ ਗੱਲਾਂ ਗੱਲਾਂ ਵਿੱਚ ਕਦੀ ਵੀ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ ਇਸ ਦੇ ਨਾਲ ਡਾਕਟਰ ਨੇ ਉਸਨੂੰ ਕੇ ਕੁਛ ਅਜਿਹੀਆ ਚੀਜ਼ਾਂ ਦੀ ਵਰਤੋਂ ਕਰਨ ਲਈ ਕਿਹਾ ਜਿਸ ਨਾਲ ਉਸ ਦੀ ਹੱਡੀ ਜੁੜ ਜਾਵੇ ਅਤੇ ਉਹ ਫਿਰ ਨੌਂ ਬਰ ਨੌਂ ਹੋ ਜਾਵੇ ਧੰਨਵਾਦ